ਕੈਬ ਬੁਕਿੰਗ ਕੰਪਨੀ ਤੋਂ ਬੋਲ ਰਹੇ ਹੋ ਜੀ ਮੈਂ ਕੈਬ ਬੁੱਕ ਕਰਵਾਈ ਸੀ ਜੀ ਗਿੱਲ ਚੌਕ ਲੁਧਿਆਣਾ ਤੋਂ ਲੈ ਕੇ ਜੀ ਐਨ ਈ ਕੋਲਜ ਇੰਜੀਨੀਅਰਿੰਗ ਕੋਲਜ ਤੱਕ ਦੀ ਅਤੇ ਉਹ ਦਸ ਵਜੇ ਲਈ ਬੁੱਕ ਕਰਾਈ ਸੀ ਅਤੇ ਮੈਂ ਗਿੱਲ ਚੌਕ ਤੋਂ ਦਸ ਵਜੇ ਚੜਨਾ ਸੀ ਅਤੇ ਸਵਾ ਦਸ ਉੱਥੇ ਪਹੁੰਚਣਾ ਸੀਗਾ ਗੁਰੂ ਨਾਨਕ ਦੇਵ ਇੰਜਨੀਅਰਿੰਗ ਕੋਲਜ ਦੇ ਵਿੱਚ ਅਤੇ ਕੈਬ ਹਜੇ ਤੱਕ ਪਹੁੰਚੀ ਨਹੀਂ ਸਵਾ ਦਸ ਮੈਨੂੰ ਇੱਥੇ ਗਿੱਲ ਚੌਂਕ ਹੀ ਹੋ ਗਏ ਅਤੇ ਤੁਸੀਂ ਕਿੱਥੇ ਹੋ ਇਸ ਟਾਈਮ ਤੁਹਾਡੀ ਲੋਕੇਸ਼ਨ ਕੁਛ ਹੋਰ ਸ਼ੋਅ ਕਰ ਰਹੇ ਤੁਸੀਂ ਨੇੜੇ ਕੀਤੇ ਹੋ ਪਰ ਹਜੇ ਤੱਕ ਪਹੁੰਚੇ ਨਹੀਂ ਹੈਗੇ ਤੁਸੀਂ ਤੁਸੀਂ ਜਲਦੀ ਪਲੀਜ਼ ਦੱਸੋ ਮੈਨੂੰ ਕਿਥ ਕਦੋਂ ਪਹੁੰਚੋਗੇ ਤੁਸੀਂ ਕਿਉਂਕਿ ਪਹਿਲਾਂ ਹੀ ਬਹੁਤ ਸਮਾਂ ਹੋ ਗਿਆ ਇਸ ਸਮੇਂ 'ਤੇ ਮੈਂ ਪਹੁੰਚਣਾ ਜ਼ਰੂਰੀ ਸੀਗਾ ਅਤੇ ਲੇਟ ਹੋ ਗਿਆ ਮੈਂ ਪਹਿਲਾਂ ਹੀ ਪਲੀਜ਼ ਤੁਸੀਂ ਜਲਦੀ ਇੱਥੇ ਆਓ ਅਤੇ ਇੱਥੋਂ ਪਿਕਅਪ ਕਰੋ ਤਾਂ ਕਿ ਆਪਾਂ ਜਲਦੀ ਟਾਈਮ ਸਿਰ ਪਹੁੰਚ ਸਕੀਏ ਸਾਢੇ ਦਸ ਵਜੇ ਪ੍ਰੋਗਰਾਮ ਸ਼ੁਰੂ ਹੋਣ ਦਾ ਟਾਈਮ ਹੈ ਜਿਸ 'ਤੇ ਪਹੁੰਚਣਾ ਮੈਂ ਸਵਾ ਦਸ ਐਂਟਰੀ ਸੀਗੀ ਅਤੇ ਪਹਿਲਾਂ ਹੀ ਮੈਂ ਲੇਟ ਹੋ ਗਿਆ ਪੰਦਰ੍ਹਾਂ ਮਿੰਟ ਤੁਸੀਂ ਲੇਟ ਕਰਤਾ ਇਹ ਮੈਨੂੰ ਜਲਦੀ ਦੱਸੋ ਕਿ ਤੁਸੀਂ ਕਦੋਂ ਪਹੁੰਚ ਰਹੇ ਹੋ ਤਾਂ ਕਿ ਮੈਂ ਵੀ ਸਮੇਂ ਸਿਰ ਪਹੁੰਚਾ ਨਹੀਂ ਫਿਰ ਮੈਂ ਜਾਂ ਕੈਂਸਲ ਕਰਾਂ ਰਾਈਡ ਮੈਨੂੰ ਵੀ ਇਹ ਦੱਸ ਦਿਓ ਕੈਂਸਲ ਕਰੋ ਮੈਂ ਕੋਈ ਹੋਰ ਬੁੱਕ ਕਰ ਲੂੰਗਾ ਰਾਈਡ ਜੇ ਤੁਹਾਨੂੰ ਟਾਈਮ ਲੱਗ ਰਿਹਾ ਹੈਗਾ ਓਕੇ